ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਕੀ ਹਾਲ ਚਾਲ ਜੀ ਹਾਂਜੀ ਹਾਂਜੀ ਹਾਂਜੀ ਸਮਝ ਗਏ ਸਮਝ ਗਏ ਜੀ ਠੀ ਹਾਂਜੀ ਆਪ ਆਪਣੇ ਤਾਂ ਜੀ ਦੋਧੀ ਦਾ ਤਾਂ ਵੀ ਆਪਣਾ ਆਪਾਂ ਇਕੱਲਾ ਦੁੱਧ ਹੀ ਲੈਂਦੇ ਹਾਂ ਜੀ ਹੈ ਨਾ ਅਤੇ ਦੁੱਧ ਵੀ ਲੱਗਿਆ ਹੋਇਆ ਆਪਣਾ ਉਰੇ ਬੂਟਰ ਡੈਰੀ ਫਾਰਮ ਲਈ ਜੀ ਅਤੇ ਉਹਨਾਂ ਤੋਂ ਆਪਣਾ ਦੁੱਧ ਆਉਂਦਾ ਜੀ ਇਹ ਆਪਣੇ ਜੀ ਜੇ ਤੁਸੀਂ ਮੱਝ ਦਾ ਲਗਵਾਉਂਦੇ ਹੋ ਪਚਵੰਜਾ ਰੁਪਏ ਕਿਲੋ ਆ ਜੀ ਅਤੇ ਆਪਣੇ ਰੋਜ਼ ਸੁਬਹਾ ਆਉਂਦਾ ਜੀ ਸ਼ਾਮ ਨੂੰ ਵੀ ਆਉਂਦਾ ਜੀ ਸੁਬਹ ਸ਼ਾਮ ਆਉਂਦੇ ਨੇ ਜੀ ਦੁੱਧ ਪਾ ਜਾਂਦੇ ਨੇ ਅਤੇ ਇਹਨਾਂ ਦਾ ਇਕੱਲਾ ਕੰਮ ਵੈਸੇ ਦੁੱਧ ਦਾ ਹੀ ਹੈ ਇਹਦੇ ਵਿੱਚ ਜੇ ਤੁਸੀਂ ਵੀ ਮਤਲਬ ਇਕੱਲਾ ਦੁੱਧ ਹੀ ਦਿੰਦੇ ਜੀ ਦਹੀਂ ਵਗੈਰਾ ਤਾਂ ਨਹੀਂ ਕਿਉਂਕਿ ਜ਼ਿਆਦਾ ਤਾਂ ਦਹੀਂ ਵਗੈਰਾ ਤਾਂ ਜਾਂ ਕੋਈ ਹੋਰ ਤੁਸੀਂ ਇੱਦਾਂ ਪਨੀਰ ਵਗੈਰਾ ਵਧੀਆ ਸਮਾਨ ਲੈਣਾ ਜੀ ਤਾਂ ਆਪਣੇ ਹੀ ਇੱਥੇ ਗੁਆਂਢ ਦੇ ਵਿੱਚ ਹੀ ਗਲੀ ਨੰਬਰ ਚਾਰ ਦੇ ਵਿੱਚ ਇੱਕ ਡੈਰੀ ਆ ਚਹਿਲ ਡੈਰੀ ਕਰਕੇ ਹੈ ਜੀ ਹਾਂਜੀ ਤਾਂ ਉਹਨਾਂ ਦੇ ਉਹਨਾਂ ਤੋਂ ਤੁਸੀਂ ਲੈ ਸਕਦੇ ਜੀ ਉਹ ਵੀ ਉਹਨਾਂ ਦਾ ਬਹੁਤ ਅਸੀਂ ਹਮੇਸ਼ਾ ਉਹਨਾਂ ਤੋਂ ਲੈਂਦੇ ਹਾਂ ਤਾਂ ਬਹੁਤ ਵਧੀਆ ਕੰਮ ਹੈ ਜੀ ਬਾਕੀ ਆਪਣੇ ਉਹ ਪੁਰਾਣੇ ਪਿੰਡ ਦੇ ਗੁਆਂਢੀ ਰਹੇ ਹੋਏ ਤਾਂ ਭਰੋਸੇ ਵਾਲਾ ਕੰਮ ਵੀ ਹੈਗੇ ਜੀ ਉੱਥੇ

ਹਾਂਜੀ ਹਾਂਜੀ ਆਪਾਂ ਨੂੰ ਭਰੋਸਾ ਹੀ ਹੈਗਾ ਕਿ ਆਪਣੇ ਪ ਪੁਰਾਣੇ ਪਿੰਡ ਦੇ ਗੁਆਂਢੀ ਹੈਗੇ ਸੀ ਤਾਂ ਉਹਨਾਂ ਨੂੰ ਜਾਣਕਾਰੀ ਵਧੀਆ ਹੈਗੀ ਉਹਨਾਂ ਨਾਲ ਅਤੇ ਸ਼ੁੱਧ ਕੰਮ ਹੈ ਜੀ ਉਹਨਾਂ ਦਾ ਵਧੀਆ ਕੰਮ ਬਾਕੀ ਤੁਸੀਂ ਵਰਤੋਂ ਗੇ ਤਾਂ ਹਾਂਜੀ ਹਾਂਜੀ ਜੀ ਜੀ ਉਹ ਤਾਂ ਗੱਲ ਤੁਹਾਡੀ ਇਕਦਮ ਸਹੀ ਹੈ ਜੀ ਆਪਣੇ ਤਾਂ ਇੱਕ ਤਾਂ ਆਪਾਂ ਨੂੰ ਇਹ ਇਲਾਕੇ ਦੇ ਵਿੱਚ ਨੇੜੇ ਬਹੁਤ ਪਊਗਾ ਕਿਉਂਕਿ ਆਪਣੇ ਦੂਜੀ ਗਲੀ ਦੇ ਵਿੱਚ ਹੀ ਗਲੀ ਨੰਬਰ ਚਾਰ ਆ ਜਿਹੜਾ ਉੱਥੇ ਵਿੱਚ ਹੀ ਹੈਗਾ ਜੀ ਤਾਂ ਆਉਣ ਜਾਣਾ ਵੀ ਇੱਥੋਂ ਸੌਖਾ ਹੈਗਾ ਜੀ ਅਤੇ ਉੱਥੋਂ ਖਰੀਦਦਾਰੀ ਕਰਨੀ ਵੀ ਆਸਾਨ ਹੈ ਅਤੇ ਬਾਕੀ ਭਰੋਸੇ ਵਾਲੇ ਬੰਦੇ ਆ ਜੀ ਤੁਸੀਂ ਉੱਥੋਂ ਲਗਵਾ ਸਕਦੇ ਹੋ ਜੀ ਤੁਸੀਂ ਚਾਹੋ ਤਾਂ ਦੁੱਧ ਵੀ ਉਹਨਾਂ ਤੋਂ ਲਵਾ ਸਕਦੇ ਹੋ ਦੁੱਧ ਇਹਨਾਂ ਦਾ ਵੀ ਰੇਟ ਆਹ ਹੀ ਚੱਲਦਾ ਜੀ ਰੇਟ ਸਾਰੇ ਮਾਨਸੇ ਆਹ ਹੀ ਆ ਜੀ ਪਚਵੰਜਾ ਰੁਪਏ ਰੇਟ ਹੈ ਪਰ ਇਹ ਬੰਦੇ ਵੀ ਆਪਣੇ ਘਰ ਦੇ ਬੰਦੇ ਬਣੇ ਹੋਏ ਨੇ ਤਾਂ ਕਰਕੇ ਇਹਨਾਂ ਤੋਂ ਆਪਾਂ ਭਰੋਸਾ ਕਰ ਸਕਦੇ ਹਾਂ ਲੈ ਸਕਦੇ ਹਾਂ ਜੀ ਦੁੱਧ ਹਾਂਜੀ ਇਹਨਾਂ ਦਾ ਦਰਅਸਲ ਇੱਦਾਂ ਹੈ ਜੀ ਇਹਨਾਂ ਦਾ ਜਿਹੜਾ ਬ ਬੇਟਾ ਹੈ ਜੀ ਹੈ ਨਾ ਉਹ ਨੌਕਰੀ ਕਰਦੇ ਆ ਜੀ ਪੁਲਿਸ 'ਚ ਤਾਂ ਕਰਕੇ ਉਹਨਾਂ ਦਾ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਪਰ ਇਹ ਫਿਰ ਆਪਣੇ ਬਾਬਾ ਬਾਬਾ ਬਾਬਾ ਜੀ ਨੇ ਜਿਹੜੇ ਉਹ ਉਹਨਾਂ ਤੋਂ ਫਿਰ ਇੰਨਾ ਤੋਰਾ ਫੇਰਾ ਨਹੀਂ ਹੁੰਦਾ ਹੈਗਾ ਇਸ ਕਰਕੇ ਉਹਨਾਂ ਨੂੰ ਜਾਣਾ ਪੈਂਦਾ ਜੀ ਤਾਂ ਕਰਕੇ ਅਸੀਂ ਵੀ ਉੱਥੋਂ ਵੀ ਕੋਈ ਦਹੀਂ ਪਨੀਰ ਇੱਦਾ ਲੈਣਾ ਹੁੰਦਾ ਤਾਂ ਉਹ ਜਾ ਕੇ ਲੈ ਆਉਂਦੇ ਆ ਅਤੇ ਦੁੱਧ ਵਾਲਾ ਫਿਰ ਅਸੀਂ ਤਾਂ ਹੀ ਭੁੱਟਰ ਨੂੰ ਲਗਵਾਇਆ ਹੋਇਆ ਵੀ ਉਹ ਆ ਕੇ ਦੇ ਜਾਂਦੇ ਨੇ ਜੀ ਹਾਂਜੀ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਠੀਕ